ਸੈਰ ਸਪਾਟਾ ਸਾਡੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਅਤੇ ਇਹ ਇਹ ਖੇਤਰ ਵਿੱਚ ਆਉਣ ਵਾਲੇ ਸੈਲਾਨੀਆਂ ਨਾਲ ਮੇਰਾ ਬਹੁਤ ਹੀ ਚੰਗਾ ਅਨੁਭਵ ਹੈ ਮੈਂ ਜਿੱਦਾਂ ਸਕੂਲ ਨੌਕਰੀ ਕਰਨ ਜਾਂਦੀ ਐਂ ਮੈਂ ਪੈਦਲ ਪਹਿਲੇ ਸ਼ਹੀਦਾਂ ਤੱਕਣ ਜਾਂਦੀ ਹਾਂ ਫਿਰ ਉਸ ਤੋਂ ਅੱਗੇ ਓਟੋ ਜਾਂਦਾ ਓਟੋ ਦੇ ਵਿੱਚ ਮੇਰੇ ਨਾਲ ਕਈ ਲੇਡੀਜ਼ ਜਾਂਦੀਆਂ ਜਿਹਦੇ ਨਾਲ ਮੇਰਾ ਬਹੁਤ ਹੀ ਵਧੀਆ ਅਨੁਭਵ ਹੈ ਅਸੀਂ ਇੱਕੋ ਸਪੋਟ 'ਤੇ ਜਾਣਾ ਹੁੰਦਾ ਇੱਕੋ ਸਪੋਟ 'ਤੇ ਆਉਣਾ ਹੁੰਦਾ ਇਸ ਕਰਕੇ ਸਾਡੀ ਆਪਸ ਦੇ ਵਿੱਚ ਥੀਂਕਿੰਗ ਬਹੁਤ ਅੱਛੀ ਹੈ ਜਿੱਦਾਂ ਮੈਂ ਕਈਆਂ ਦੀ ਮਦਦ ਕਰਦੀ ਹਾਂ ਅਤੇ ਉਹ ਵੀ ਉਸੇ ਬੇਸ 'ਤੇ ਮੇਰੀ ਮਦਦ ਕਰਕੇ ਮੇਰੀ ਬਹੁਤ ਜ਼ਿਆਦਾ ਮਦਦ ਕਰਦੇ ਤਾਂ ਕਿ ਸਾਨੂੰ ਉਸੇ ਹੀ ਲੈਵਲ ਦੇ ਉੱਤੇ ਬਹੁਤ ਅੱਛੀ ਅਨੁਭਵ ਪ੍ਰਾਪਤ ਹੁੰਦਾ ਹੈ ਜਿ ਜਿਵੇਂ ਕਿ ਮੈਂ ਕਿਸੇ ਦੀ ਮਦਦ ਕਰ ਦਿੰਦੀ ਹਾਂ ਜਿਹਦੇ ਜਿੱਦਾਂ ਅਸੀਂ ਸਕੂਲ ਪੜ੍ਹਾਉਂਦੇ ਹਾਂ ਅਤੇ ਉਹ ਜਿੱਦਾਂ ਕਿਸੇ ਕੰਮ ਦੇ ਵਿੱਚ ਉਹਨੂੰ ਅਨੁਭਵ ਨਹੀਂ ਹੈਗਾ ਉਹ ਅਨੁਭਵ ਮੈਨੂੰ ਹੈ ਮੈਂ ਉਹਨੂੰ ਸਿਖਾ ਦਿੰਦੀ ਹਾਂ ਤਾਂ ਕਿ ਉਹਨੂੰ ਪਤਾ ਲੱਗਦਾ ਹਾਂ ਵੀ ਇਹ ਬਹੁਤ ਅੱਛਾ ਅਨੁਭਵ ਸਾਨੂੰ ਦੇ ਸਕਦੇ ਇਸ ਤਰ੍ਹਾਂ ਹੀ ਉਹ ਸਾਡੀ ਹੈਲਪ ਕਰ ਸਕਦੇ ਕਿਸੇ ਹੋਰ ਖੇਤਰ ਵਿੱਚ ਅਤੇ ਜਿਹਦੇ ਨਾਲ ਅਸੀਂ ਕਾਫੀ ਅੱਗੇ ਵਧ ਸਕਦੇ ਹੈ ਇਸ ਕਰਕੇ ਜਿਹੜੇ ਸੈਲਾਨੀ ਸਾਡੇ ਨਾਲ ਜਾਂਦੇ ਆ ਉਹਦੇ ਨਾਲ ਮੇਰਾ ਬਹੁਤ ਹੀ ਚੰਗਾ ਅਨੁਭਵ ਹੈ ਉਹ ਮੈਨੂੰ ਬਹੁਤ ਹੀ ਚੰਗਾ ਸਮਝਦੇ ਅਤੇ ਮੈਂ ਵੀ ਉਹਨਾਂ ਨੂੰ ਬਹੁਤ ਹੀ ਚੰਗਾ ਸਮਝਦੀ ਹਾਂ ਇਸੇ ਚੰਗੇ ਦੇ ਵਿੱਚ ਸਾਡਾ ਬਹੁਤ ਹੀ ਵਧੀਆ ਨਿਕਲੀ ਜਾ ਰਹੀ ਹੈ ਸਕੂਲ ਜੋਬ ਮੈਨੂੰ ਬਹੁਤ ਹੀ ਅੱਛੀ ਲੱਗ ਰਹੀ ਹੈ ਸਕੂਲ ਜਾ ਕੇ ਮੈਂ ਕਸ ਕਈਆਂ ਦੇ ਅਨੁਭਵ ਚੰਗੀ ਤਰ੍ਹਾਂ ਕੋ ਕਈ ਚੀਜ਼ਾਂ ਉਹਨਾਂ ਕੋਲੋਂ ਸਿੱਖਦੀ ਹਾਂ ਅਤੇ ਮੈਂ ਆਪਣੀਆਂ ਚੰਗੀਆਂ ਸਿੱਖਿਆਵਾਂ ਵੀ ਉਹਨਾਂ ਨੂੰ ਕਈ ਦੇ ਸਕਦੀ ਹਾਂ ਇਸ ਕਰਕੇ ਸੈਰ ਸਪਾਟਾ ਸ ਜਿਹੜਾ ਹੈਗਾ ਸਾਡੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਬਹੁਤ ਹੀ ਜ਼ਿਆਦਾ ਬਿਹਤਰ ਬਣਾਉਂਦਾ ਮੈਨੂੰ ਇਹ ਜਿਹੜਾ ਸੈਰ ਸਪਾਟੇ ਦੇ ਵਿੱਚ ਜਿਹੜੇ ਅਨੁਭਵ ਹੁੰਦੀ ਹੈ ਇਹ ਬਹੁਤ ਹੀ ਚੰਗੇ ਲੱਗਦੇ ਆ ਇਸ ਕਰਕੇ ਮੈਂ ਆਪਣਾ ਅਨੁਭਵ ਕਿਸੇ ਕੋਈ ਗਵਾਉਣਾ ਨਹੀਂ ਚਾਹੁੰਦੀ ਜਿੱਥੋਂ ਜੋ ਮੈਨੂੰ ਅਨੁਭਵ ਪ੍ਰਾਪਤ ਹੁੰਦਾ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਗ੍ਰਹਿਣ ਕਰਦੀ ਹੈ ਅਤੇ ਮੈਂ ਦੂਜਿਆਂ ਨੂੰ ਵੀ ਬਹੁਤ ਜ਼ਿਆਦਾ ਅਨੁਭਵੀ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਕਿ ਉਹ ਵੀ ਬਹੁਤ ਵਧੀਆ ਅਨੁਭਵੀ ਬਣ ਸਕੇ ਸਾਡੇ ਨਾਲ ਰੁਜ਼ਗਾਰ 'ਤੇ ਜਾਣ ਨਾਲ ਬਹੁਤ ਹੀ ਵਧੀਆ ਹੁੰਦਾ ਹੈ